ਹੈਲੋ ਅੱਛਾ ਜਸਮੀ ਉਹ ਪਟਿਆਲੇ ਵਾਲੀ ਹਾਂਜੀ ਉਹ ਮੇਰੀ ਹਾਂ ਭੂਆ ਦੀ ਕੁੜੀ ਹੈ ਜੀ ਮੇਰੀ ਉਹ ਅੱਛਾ ਜੀ ਤੁਸੀਂ ਇੱਧਰ ਨਵਾਂ ਸ਼ਹਿਰ ਵੱਲ੍ਹ ਆਉਣਾ ਓਕੇ ਓਕੇ ਕਦੋਂ ਆਉਣਾ ਤੁਸੀਂ ਹਾਂਜੀ ਹਾਂਜੀ ਕੋਈ ਨਹੀਂ ਜੀ ਤੁਸੀਂ ਸਾਡੇ ਇੱਥੇ ਰਹਿ ਲਿਓ ਅਤੇ ਜਗ੍ਹਾਵਾਂ ਇੱਥੇ ਹੈਗੀਆਂ ਕਾਫ਼ੀ ਘੁੰਮਣ ਵਾਸਤੇ ਇੱਥੇ ਗੁਰਦੁਆਰੇ ਹੈ ਜੀ ਇਹ ਰਾਜਾ ਸਾਹਿਬ ਗੁਰਦੁਆਰਾ ਆ ਉੱਥੇ ਘੁੰਮ ਸਕਦੇ ਐਂ ਜੀ ਅਤੇ ਫਿਰ ਟਿੱਬੀ ਸਾਹਿਬ ਆ ਕਾਫ਼ੀ ਫੇਮਸ ਹੈ ਸਤਿਲੁਜ ਸਤਿਲੁਜ ਦਰਿਆ ਸਤ ਸਤਿਲੁਜ ਦਰਿਆ ਕੋਲ ਪੈਂਦਾ ਟਿੱਬੀ ਸਾਹਿਬ ਆ ਹੋਰ ਬੰਦਲੀ ਸ਼ੇਰ ਹੋਰ ਭਗਤ ਸਿੰਘ ਦਾ ਰੈਜੀਡੈਂਟ ਵੀ ਹੈਗਾ ਜੀ ਘੁੰਮਣ ਵਾਸਤੇ ਕਾਫ਼ੀ ਹੈ ਘੁੰਮਣ ਵਾਸਤੇ ਸਾਰਾ ਦਿਨ ਨਿੱਕਲ ਸਕਦਾ ਹਾਂਜੀ ਫਿਰ ਪਰਸੋਂ ਪੱਕਾ ਆਓਂਗੇ ਅੱਛਾ ਜੀ ਠੀਕ ਹੈ ਜੀ ਅਤੇ ਸਾਡੇ ਕੋਲ ਹੈਗਾ ਜੀ ਆਪਣੀ ਗੱਡੀ ਹੈਗੀ ਆ ਅਤੇ ਉਹਦੀ ਟੈਨਸ਼ਨ ਨਾ ਲਿਓ ਕਰਲਾਂਗੇ ਉਹਦੀ ਵਹਿਕਲ ਦੀ ਕੋਈ ਟੈਨਸ਼ਨ ਨਹੀਂ ਅਤੇ ਕੱਲਿਆਂ ਆਏ ਹੈ ਜਾਂ ਫੈਮਿਲੀ ਵੀ ਆਊਂਗੀ ਤੁਹਾਡੇ ਕੋਲ ਨਾਲ਼ ਵੀ ਕੋਈ ਅੱਛਾ ਜੀ ਕਿੰਨੇ ਕੁ ਜਣੇ ਆ ਚਲੋ ਠੀਕ ਹੈ ਜੀ ਅਤੇ ਕਿਹੜੇ ਟਾਈਮ ਮੈਨੂੰ ਐਂ ਕਰਿਓ ਜਦੋਂ ਪਰਸੋਂ ਤੁਸੀਂ ਆ ਗਏ ਨਾ ਮੈਨੂੰ ਕੋਲ ਕਰ ਲਿਓ ਤੁਹਾਨੂੰ ਮੈਂ ਪਿੱਕ ਅੱਪ ਕਰਲੂਂਗਾ ਠੀਕ ਹੈ ਓਕੇ ਥੈਂਕ ਯੂ